ਮੈਂ ਆਪਣੇ ਯੋਗਾ ਸੈਸ਼ਨ ਦੌਰਾਨ ਸੋਚ ਨੂੰ ਪੈਦਾ ਹੋਣ ਤੋਂ ਰੋਕਣ ਦੀ ਅਥੱਕ ਕੋਸ਼ਿਸ਼ ਕਰਦਾ ਹਾਂ ਮੈਂ ਇਸ ਅਭਿਆਸ ਵਿੱਚ ਰਹਿੰਦਾ ਹਾਂ ਕਿ ਜ ਜਦ ਵੀ ਮੈਂ ਯੋਗਾ ਕਰਾਂ ਤਾਂ ਮੇਰਾ ਪੂਰਨ ਧਿਆਨ ਸਿਰਫ ਯੋਗ ਹੈ ਵੱਲ ਹੋਵੇ ਨਾ ਕਿ ਕਿਸੇ ਹੋਰ ਗਤੀਵਿਧੀ ਵੱਲ ਮੇਰਾ ਧਿਆਨ ਚਲਾ ਜਾਵੇ ਜਿਸ ਕਾਰਨ ਲੈਅ ਟੁੱਟਦੀ ਹੈ ਅਤੇ ਸਾਰਾ ਕੀਤਾ ਹੀ ਹੋਈ ਮਿਹਨਤ ਨੇਹ ਫੜ ਹੋ ਸਕਦੀ ਹੈ ਜੇਕਰ ਅਸੀਂ ਇਕਾਗਰ ਚਿੱਤ ਹੋ ਕੇ ਕੋਈ ਵੀ ਕੰਮ ਨਹੀਂ ਕਰਾਂਗੇ ਤਾਂ ਯਕੀਨਨ ਹੀ ਸਾਨੂੰ ਉਸ ਕੰਮ ਦਾ ਫਲ ਪ੍ਰਾਪਤ ਨਹੀਂ ਹੋਵੇਗਾ ਇਸ ਲਈ ਮੈਂ ਯੋਗਾ ਕਰਦੇ ਸਮੇਂ ਕੁਝ ਹੋਰ ਨਹੀਂ ਸੋਚਦਾ ਪਰ ਯੋਗਾ ਕਰਦੇ ਸਮੇਂ ਸਕਾਰਾਤਮਕ ਚੀਜ਼ਾਂ ਗੱਲਾਂ ਜਰੂਰ ਜਿਹਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਇਸ ਦੇ ਤੁਹਾਡੀ ਸਿਹਤ ਉੱਪਰ ਚੰਗੇ ਪ੍ਰਭਾਵ ਪੈਂਦੇ ਹਨ ਜੇਕਰ ਯੋਗਾ ਕਰਦੇ ਸਮੇਂ ਅਸੀਂ ਇਕਾਗਰ ਚਿੱਤ ਹੋਵਾਂਗੇ ਤਾਂ ਯਕੀਨਨ ਹੀ ਸਾਡੇ ਸਰੀਰ ਦੀਆਂ ਅੰਦਰਲੀਆਂ ਨਾੜੀਆਂ ਅਤੇ ਅੰਗਾਂ ਵਿੱਚ ਵਿੱਚ ਲੋੜੀਦੀ ਹਰਕਤ ਪੈਦਾ ਹੋਵੇਗੀ ਜੋ ਕਿ ਅਸੀਂ ਯੋਗਾ ਰਾਹੀਂ ਕਰਨਾ ਚਾਹੁੰਦੇ ਹਾਂ ਇਸ ਦਾ ਸਾਡੇ ਸਰੀਰ ਨੂੰ ਫਾਇਦਾ ਹੋਵੇਗਾ ਸਾਡੇ ਜੀਵਨ ਵਿੱਚ ਸੋਚ ਦਾ ਬਹੁਤ ਮਹੱਤਵ ਹੈ ਜੇਕਰ ਅਸੀਂ ਕੁਝ ਵੀ ਚੰਗਾ ਸੋਚਦੇ ਹਾਂ ਤਾਂ ਉਹ ਸਾਨੂੰ ਨਤੀਜੇ ਚੰਗੇ ਪ੍ਰਾਪਤ ਹੁੰਦੇ ਹਨ ਸਾਡੀ ਸੋਚ ਸਾਡੇ ਸੁਭਾਅ ਨੂੰ ਚੰਗਾ ਬਣਾਉਂਦੀ ਹੈ ਸਾਡਾ ਸੁਭਾਅ ਸਾਡੀਆਂ ਆਦਤਾਂ ਨੂੰ ਚੰਗਾ ਬਣਾਉਂਦਾ ਹੈ ਸਾਡੀਆਂ ਆਦਤਾਂ ਸਾਡੀਆਂ ਗਤੀਵਿਧੀਆਂ ਨੂੰ ਚੰਗਾ ਬਣਾਉਂਦੀਆਂ ਹਨ ਸਾਡੀਆਂ ਗਤੀਵਿਧੀਆਂ ਸਾਡੇ ਜੀਵਨ ਨੂੰ ਸਫਲਾ ਕਰਦੀਆਂ ਹਨ ਇਸ ਲਈ ਚੰਗੀ ਸੋਚ ਜੀਵਨ ਵਿੱਚ ਸਫਲ ਹੋਣ ਲਈ ਬਹੁਤ ਜਰੂਰੀ ਹੁੰਦੀ ਹੈ